ਪੰਜਾਬ ਵਿੱਚ ਕਾਰੋਬਾਰ ਦੇ ਮੌਕੇ ਬਹੁਤ ਘੱਟ ਗਏ ਨੇ ਜਿਸ ਕਾਰਨ ਯੂਥ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਵਿੱਚ ਜਾਣਾ ਬਹੁਤ ਪਸੰਦ ਕਰ ਰਹੀ ਹੈ ਲੇਕਿਨ ਪੰਜਾਬ ਵਿੱਚ ਮੌਕਿਆਂ ਦੀ ਗੱਲ ਕਰੀਏ ਜੇ ਕਾਰੋਬਾਰ ਦੇ ਮੌਕਿਆਂ ਦੀ ਗੱਲ ਕਰੀਏ ਤਾਂ ਬੈਟਰੀ ਰੀਕੰਡੀਸ਼ਨਿੰਗ ਹੈਂਡਲੂਮ ਟੈਕਸਟਾਈਲਸ ਰਿਕਰੂਟਮੈਂਟ ਅਜੈਂਸੀ ਵਰਗੀਆਂ ਫੀਲਡ ਦੇ ਵਿੱਚ ਬਹੁਤ ਹੀ ਮੌਕੇ ਨੇ ਜਿਵੇਂ ਕਿ ਰਿਕਰੂਟਮੈਂਟ ਅਜੈਂਸੀਆਂ ਦਾ ਕੰਮ ਹੈ ਅੱਜ ਕੱਲ੍ਹ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿੱਥੇ ਜੌਬਸ ਨਿਕਲੀਆਂ ਨੇ ਕਿੱਥੇ ਅਸਾਮੀਆਂ ਰਾਖਵੀਆਂ ਨੇ ਕਿੱਥੇ ਘੱਟ ਨੇ ਕਿੱਥੇ ਲੋੜ ਹੈ ਉਹ ਕੰਮ ਜਿਹੜਾ ਹੈ ਅੱਜ ਕੱਲ੍ਹ ਬਹੁਤ ਪ੍ਰਚਲਣ ਵਿੱਚ ਹੈ ਲੁਕ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਰਿਕਰੂਟਮੈਂਟ ਅਜੈਂਸੀਆਂ ਦੇ ਥਰੂ ਹੀ ਅੱਜ ਕੱਲ੍ਹ ਬੰਦਿਆਂ ਨੂੰ ਕੰਮ ਦੇ ਰਹੀਆਂ ਨੇ ਜ ਜਦ ਕਿ ਸਰਕਾਰੀ ਮਹਿਕਮਿਆਂ ਵਿੱਚ ਵੀ ਅੱਜ ਕੱਲ੍ਹ ਰਿਕਰੂਟਮੈਂਟ ਅਜੈਂਸੀਆਂ ਦੇ ਥਰੂ ਹੀ ਕੰਮ ਕੀਤਾ ਜਾ ਰਿਹਾ ਹੈ ਬੰਦੇ ਉੱਥੇ ਭਰਤੀ ਜਿਹੜੀ ਹੁੰਦੀ ਹੈ ਰਿਕਰੂਟਮੈਂਟ ਅਜੈਂਸੀਆਂ ਦੇ ਥਰੂ ਹੀ ਹੁੰਦੀਆਂ ਨੇ ਅਤੇ ਇਹ ਜਿਹੜੀਆਂ ਮਤਲਬ ਕਾਰੋਬਾਰ ਦੇ ਲਈ ਬਹੁਤ ਸਾਰੇ ਵਧੀਆ ਫੀਲਡ ਨੇ ਇਹ ਸਾਰੀਆਂ ਧੰਨਵਾਦ